ਪੁਰਾਣੇ ਅਤੇ ਨਵੇਂ ਮੀਡੀਆ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈ ਜਿਵੇਂ ਕਿ ਪੁਰਾਣੇ ਪੁਰਾਣੇ ਲੋਕ ਹੁੰਦੇ ਸੀਗੇ ਉਹ ਮਤਲਬ ਕਿ ਬੈਠਦੇ ਸੀਗੇ ਸਾਰੇ ਜਾਣੇ ਇਕੱਠੇ ਉਹ ਰੇਡੀਓ 'ਤੇ ਨਿਊਜ਼ ਦੇਖਦੇ ਸੀ ਮਤਲਬ ਕਿ ਤਿੰਨ ਚਾਰ ਦਿਨ ਬਾਅਦ ਜਾਂ ਚਾਰ ਪੰਜ ਦਿਨਾਂ ਬਾਅਦ ਜਾ ਕੇ ਨਿਊਜ਼ ਉਹਨਾਂ ਨੂੰ ਆਉਂਦੀ ਸੀਗੀ ਜਿਵੇਂ ਕਿ ਮਤਲਬ ਕਿ ਕੋਈ ਵੀ ਗੱਲ ਹੁੰਦੀ ਸੀਗੀ ਤਾਂ ਰੇਡੀਓ ਐਫ ਐਮ ਰੇਡੀਓ ਹੁੰਦਾ ਸੀਗਾ ਉਹ ਉਹਨਾਂ ਨੂੰ ਮਤਲਬ ਦੱਸ ਦਿੰਦਾ ਹੁੰਦਾ ਸੀਗਾ ਬਟ ਇਗਜੈਕਟਲੀ ਓਨ ਦਾ ਪਲੇਸ ਉਹ ਨਿਊਜ਼ ਨਹੀਂ ਪਤਾ ਲੱਗਦੀ ਸੀਗੀ ਪਰ ਅੱਜ ਕੱਲ੍ਹ ਦੇ ਮਤਲਬ ਕਿ ਅੱਜ ਕੱਲ੍ਹ ਇਹੋ ਇਹੋ ਜਿਹੀ ਮ ਮਤਲਬ ਕਿ ਵਾਸਟ ਡਿਵੈਲਪਮੈਂਟ ਹੋ ਗਈ ਆ ਕਿ ਆਪਾਂ ਨੂੰ ਮਤਲਬ ਕਿ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਹਾਂ ਆਪਣੇ ਅੋਨਲਾਈਨ ਜਾਂ ਆਪਾਂ ਨੂੰ ਖਬਰਾਂ ਮਿਲਣ ਲੱਗ ਜਾਂਦੀਆਂ ਆਪਣੇ ਅੋਨਲਾਈਨ ਮੋਬਾਇਲ ਫੋਨਸ ਟੀ ਵੀ ਫੋਨਸ ਇਹਨਾਂ 'ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹਾਂ ਉੱਥੇ ਕੀ ਹੋਣਦਿਆਂ ਹੈ ਨਾਲ ਦੀ ਨਾਲ ਆਪਾਂ ਨੂੰ ਨਿਊਜ਼ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਪੁਰਾਣੇ ਪੁਰਾਣੇ ਜ਼ਮਾਨੇ ਵਿੱਚ ਇਹ ਚੀਜ਼ ਨਹੀਂ ਹੁੰਦੀ ਸੀਗੀ ਮਤਲਬ ਕਿ ਉਦੋਂ ਨਾਲ ਦੀ ਨਾਲ ਖਬਰ ਨਹੀਂ ਮਿਲਦੀ ਸੀਗੀ ਨਿਊ ਅਗਲੇ ਦਿਨ ਮਿਲਦੀ ਹੀ ਹਾਂ ਫੇਰ ਦੋ ਤਿੰਨ ਦਿਨ ਬਾਅਦ ਮਿਲਦੀ ਸੀਗੀ ਫੋਨਸ ਨਹੀਂ ਹੁੰਦੇ ਸੀਗੇ ਹੁਣ ਡਿਵੈਲਪਮੈਂਟ ਟਕਨੋਲਜੀ ਇੰਨੀ ਜ਼ਿਆਦਾ ਵੱਧ ਗਈ ਹੋਈ ਹੈ ਕਿ ਆਪਾਂ ਨੂੰ ਨਾਲ ਦੀ ਨਾਲ ਹੀ ਆਪਣੀਆਂ ਮਤਲਬ ਖਬਰਾਂ ਮਿਲ ਜਾਂਦੀਆਂ ਕਿ ਹਾਂ ਇੱਥੇ ਆਹ ਹੋ ਰਿਹਾ ਉੱਥੇ ਉਹ ਹੋ ਰਿਹਾ ਹੈ ਜਿਹਦੇ ਨਾਲ ਮਤਲਬ ਕਿ ਆਪਾਂ ਥੋੜ੍ਹਾ ਫਾਸਟ ਡਿਵੈਲਪਮੈਂਟ ਕਰ ਰਹੇ ਹਾਂ